ਭਾਰਤ ਵਿੱਚ ਚਾਹ ਸਭ ਨੂੰ ਪਸੰਦ ਹੈ ਜੀ ਮੈਨੂੰ ਖੁਦ ਨੂੰ ਬਹੁਤ ਪਸੰਦ ਆ ਮੈਂ ਹੁਣ ਜਿੱਦਾਂ ਸਰਦੀ ਚੱਲਦੀ ਪਈ ਆ ਤਾਂ ਦੋ ਤਿੰਨ ਵਾਰੀ ਚਾਹ ਹੈ ਜਿਹੜੀ ਸਾਡੇ ਘਰ ਬਣਦੀ ਅਤੇ ਮੇਰੀ ਜਿਹੜੀ ਉਹ ਸਪੈਸ਼ਲ ਚਾਹ ਜੀ ਮੈਂ ਗੁੜ ਵਾਲੀ ਚਾਹ ਅਤੇ ਖੰਡ ਵਾਲੀ ਚਾਹ ਜਾਂ ਸਪੈਸ਼ਲ ਜਿਹੜਾ ਮਸਾਲਾ ਉਹ ਘਰ ਵਾਲਾ ਉਹ ਵਰਤ ਕੇ ਚਾਹ ਬਣਾਉਂਦੇ ਹਾਂ ਜਿਸ ਤਰਾਂ ਜਿਹੜੇ ਮਸਾਲੇ ਨੇ ਉਹਦੇ ਵਿੱਚ ਵੱਡੀ ਇਲਾਇਚੀ ਛੋਟੀ ਇਲਾਇਚੀ ਲੌਂਗ ਦਾਲ ਚੀਨੀ ਮਲੱਠੀ ਸੁੰਢ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਨੇਗੀਆਂ ਉਹ ਅਸੀਂ ਸਾਰੀਆਂ ਜਿੱਦਾਂ ਖੜੇ ਮਸਾਲੇ ਇਹ ਵਾਲੇ ਚੀਜ਼ਾਂ ਸਾਬਤ ਲੈ ਕੇ ਉਸਨੂੰ ਪੀਸ ਕੇ ਅਤੇ ਮਸਾਲਾ ਤਿਆਰ ਕਰ ਲਈਦਾ ਬਾਕੀ ਜਿਹੜੀ ਪੱਤੀ ਆ ਉਹ ਵੀ ਫਿਰ ਥੋੜ੍ਹੀ ਬ੍ਰਾਂਡ ਦੀ ਵਰਤੋਂ ਜਿੱਦਾਂ ਰੈੱਡ ਲੇਬਲ ਹੋ ਗਈ ਮ ਤਾਜ ਮਹਿਲ ਹੋ ਗਈ ਇੱਦਾਂ ਦੀ ਹੈ ਨਾ ਲੋਕਲ ਜਿਹੜੀਆਂ ਪੱਤੀਆਂ ਨੇ ਮੰਨ ਲਉ ਜਿਹੜੀ ਲੋਕਲ ਪੱਤੀ ਆ ਉਹਦੇ ਵਿੱਚ ਕੁਛ ਮਿਲਾਵਟ ਹੁੰਦੀ ਆ ਇਸ ਕਰਕੇ ਥੋੜ੍ਹੀ ਮੈਨੂੰ ਨਹੀਂ ਵਧੀਆ ਲੱਗਦੀ ਅਤੇ ਚਾਹ ਦੇ ਲਈ ਬਸ ਸਿੰਪਲ ਆ ਜੀ ਪਾਣੀ ਰੱਖੋ ਪਾਣੀ ਵਿੱਚ ਥੋੜ੍ਹਾ ਮਸਾਲਾ ਪਾਓ ਫਿਰ ਚਾਹ ਪੱਤੀ ਪਾਓ ਜਿਸ ਤਰਾਂ ਉਹ ਚੰਗੀ ਤਰ੍ਹਾਂ ਰਿੱਝ ਗਈ ਅਤੇ ਥੋੜ੍ਹੀ ਅਸੀਂ ਦੁੱਧ ਵਾਲੀ ਚਾਹ ਜਿਹੜੀ ਉਹ ਪਸੰਦ ਕਰਦੇ ਹਾਂ ਬਾਕੀ ਵਿੱਚ ਥੋੜ੍ਹਾ ਅਦਰਕ ਸਰਦੀਆਂ ਵਿਚ ਅਦਰਕ ਪਾ ਸਕਦੇ ਹਾਂ ਅਤੇ ਹਾਂਜੀ ਇਸ ਤਰ੍ਹਾਂ ਜਿਹੜੀ ਚਾਹ ਹੈ ਉਹ ਸਾਡੀ ਰੈਡੀ ਹੋ ਜਾਂਦੀ ਆ ਅਸੀਂ ਥੋੜ੍ਹੀ ਜੇ ਤੁਸੀਂ ਗੁੜ ਵਾਲੀ ਪੀਣੀ ਚਾਹੁੰਦੇ ਹੋ ਤਾਂ ਵਿੱਚ ਗੁੜ ਪਾ ਲਓ ਐਂਡ 'ਤੇ ਨਹੀਂ ਤਾਂ ਤੁਸੀਂ ਚੀਨੀ ਪਾਓ ਥੋੜ੍ਹਾ ਲਾਈਟ ਮਿੱਠਾ ਤਾਂ ਬੜੀ ਸਵਾਦ ਚਾਹ ਬਣਦੀ ਆ ਜੀ